ਲੋਕਡਾਊਨ 'ਚ ਸਾਰੇ ਜਣੇ ਘਰ ਰਹਿ ਰਹਿ ਕੇ ਸ਼ੈਫ ਹੀ ਬਣੇ ਹੋਏ ਸੀ ਕਿਉਂਕਿ ਸਾਰਾ ਕੁਛ ਸਾਰਾ ਦਿਨ ਟਾਈਮ ਤਾਂ ਘਰ ਬੈਠੇ ਰਹਿਣਾ ਵਿਹਲੇ ਬਹੁਤ ਔਖਾ ਕੰਮ ਸੀ ਅਤੇ ਬਾਹਰੋਂ ਵੀ ਕੁਛ ਮੰਗਾ ਕੇ ਖਾ ਨਹੀ ਸਕਦੇ ਸੀ ਬੱਚੇ ਵੀ ਘਰ ਅਤੇ ਬੱਚਿਆਂ ਦੀਆਂ ਅਲੱਗ ਅਲੱਗ ਫਰਮਾਇਸ਼ਾਂ ਚਲਦੀਆਂ ਰਹਿੰਦੀਆਂ ਸੀ ਆਹ ਖਾਣਾ ਉਹ ਖਾਣਾ ਸਭ ਤੋਂ ਪਹਿਲਾਂ ਤਾਂ ਅਸੀ ਮਿੱਠੇ ਤੋਂ ਟਰਾਈ ਕੀਤਾ ਮੈਂ ਸਪੰਜੀ ਰਸਗੁੱਲੇ ਬਣਾਏ ਅਤੇ ਇੱਕ ਰਸ ਮਲਾਈ ਬਣਾਈ ਘਰ ਅਤੇ ਜਲੇਬੀਆਂ ਬਣਾਈਆਂ ਅਤੇ ਬੱਚਿਆਂ ਨੂੰ ਪੂਰੀਆਂ ਪਸੰਦ ਆਈਆਂ ਜਲੇਬੀਆਂ 'ਚ ਥੋੜ੍ਹਾ ਜਿਹਾ ਸ਼ਾਇਦ ਕੁਛ ਗੜਬੜ ਹੋ ਗਈ ਸੀ ਉਹ ਬੱਚਿਆਂ ਨੂੰ ਬਾਜ਼ਾਰ ਵਰਗੀਆਂ ਨਹੀ ਲੱਗੀਆਂ ਪਰ ਸਪੰਜੀ ਰਸਗੁੱਲੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਅਤੇ ਰਸਮਲਾਈ ਵੀ ਬਹੁਤ ਵਧੀਆ ਲੱਗੀ ਫਿਰ ਨਮਕੀਨ 'ਚ ਮੇਰੇ ਲਈ ਵੱਡੀ ਪ੍ਰੋਬਲਮ ਇਹ ਹੈ ਕਿ ਮੇਰੀ ਬੇਟੀ ਨੂੰ ਕਣਕ ਦੀ ਐਲਰਜੀ ਹੈਗੀ ਆ ਇਸ ਲਈ ਫਿਰ ਮੈਨੂੰ ਉਹਦੇ ਲਈ ਗਲੂਟਨ ਫਰੀ ਡਾਇਟ ਵਾਲਾ ਹੀ ਕੁਛ ਨਾ ਕੁਛ ਜਿਵੇਂ ਬਣਾਉਂਣਾ ਪੈਂਦਾ ਫਿਰ ਮੈਂ ਛੁੱਟੀਆਂ 'ਚ ਯੂਟਿਊਬ ਤੋਂ ਦੇਖ ਦੇਖ ਕੇ ਇੱਕ ਤਾਂ ਉਹਦੇ ਲਈ ਡੋਸਾ ਬਣਾਉਂਣਾ ਸਿੱਖਿਆ ਅਤੇ ਇੱਕ ਇਡਲੀ ਵੀ ਬਣਾਉਂਣੀ ਸਿੱਖੀ ਵੜਾ ਸਿੱਖਿਆ ਅਤੇ ਉਹਦੀ ਮਤਲਬ ਜਿਹੜਾ ਉਹਦਾ ਮਿਕਸ ਆਟਾ ਹੁੰਦਾ ਨਾ ਉਸ ਆਟੇ ਦਾ ਹੀ ਮੈਂ ਕੇਕ ਵੀ ਟਰਾਈ ਕੀਤਾ ਅਤੇ ਉਹਨੂੰ ਹਲਵਾ ਵੀ ਹਲਵਾ ਵੀ ਬਣਾ ਕੇ ਦਿੱਤਾ ਉਹਨੂੰ ਵੀ ਮਤਲਬ ਚੰਗਾ ਲੱਗਿਆ ਅਤੇ ਓਵਨ 'ਚ ਮੈਂ ਉਸ ਬੇਟੀ ਦੇ ਆਟੇ ਦੀ ਉਹਨੂੰ ਬਿਸਕਿਟ ਵੀ ਬਣਾ ਕੇ ਦਿੱਤੇ ਅਤੇ ਉਹਦਾ ਬ੍ਰੈਡ ਵੀ ਬਹੁਤ ਵਧੀਆ ਬਣਿਆ ਮਤਲਬ ਉਹ ਪੂਰੀ ਖੁਸ਼ ਸੀ ਕਿਉਂਕਿ ਮਾਰਕੀਟ 'ਚ ਉਹਦੀਆਂ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਇਹੋ ਜਿਹੀਆਂ ਉਹਦੀਆਂ ਨਹੀ ਮਿਲਦੀਆਂ ਖਾਣ ਵਾਲੀਆਂ ਇਸ ਲਈ ਮੈਂ ਬੇਟੀ ਦੀ ਐਲਰਜੀ ਟਾਈਪ ਜੋ ਉਹਦੇ ਆਟੇ ਤੋਂ ਜਿਹੜਾ ਕੁਛ ਬਣਾ ਸਕਦੇ ਸੀ ਉਹ ਉਹਨੂੰ ਸਾਰਾ ਕੁਛ ਬਣਾ ਬਣਾ ਕੇ ਮਤਲਬ ਲੋਕਡਾਊਨ 'ਚ ਖਲਾਇਆ ਹੈਗਾ ਅਤੇ ਉਹ ਵੀ ਖੁਸ਼ ਅਤੇ ਮੇਰਾ ਵੀ ਟਾਈਮ ਚੰਗਾ ਪਾਸ ਹੋਇਆ ਕਿਉਂਕਿ ਬੱਚੇ ਅੱਜ ਕੱਲ੍ਹ ਸਾਰੇ ਫਾਸਟ ਫੂਡ ਦੀ ਸ਼ੌਕੀਨ ਹੈਗੇ ਆ ਅਤੇ ਉਹਨੂੰ ਕਣਕ ਦੀ ਐਲਰਜੀ ਹੋਣ ਕਰਕੇ ਅਸੀ ਬਾਹਰ ਦਾ ਖਾਣਾ ਦੇਣ ਤੋਂ ਉਹਨੂੰ ਵਾਰ ਵਾਰ ਰੋਕਦੇ ਰਹਿੰਦੇ ਹੈਗੇ ਹਾਂ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਪਰ ਘਰ ਮੈਂ ਸਾਰੇ ਤਰ੍ਹਾਂ ਦੇ ਸਨੈਕਸ ਵਗੈਰਾ ਵੀ ਉਹਦੇ ਮਤਲਬ ਤਾਂ ਜਿਵੇਂ ਵਿੱਚ ਮੈਦਾ ਜਾਂ ਵੀਟ ਵਗੈਰਾ ਲੱਗੀ ਹੁੰਦੀ ਆ ਜਿਹੜੇ ਆਪਾਂ ਰੈਡੀਮੇਡ ਲੈਦੇ ਹਾਂ ਅਤੇ ਪਰ ਮੈਂ ਉਸੇ ਦੇ ਆਟੇ ਨਾਲ ਹੀ ਉਹਨੂੰ ਕਰਕੇ ਸਾਰੇ ਤਰ੍ਹਾਂ ਦੇ ਬਣਾ ਕੇ ਦਿੱਤੇ ਫਰੈਂਚ ਫਰਾਈਜ਼ ਵਗੈਰਾ ਜੋ ਵੀ ਮਤਲਬ ਉਹਦੇ ਆਟੇ ਨਾਲ ਬਣਦਾ ਉਹਦੇ ਆਟੇ ਨਾਲ ਹੀ ਮੈਂ ਜਿਵੇਂ ਮੂੰਗ ਦਾਲ ਦੇ ਭੱਲੇ ਵੀ ਉਹਦੇ ਉੱਤੇ ਰੋਲ ਕਰਕੇ ਬਣਾਏ ਬਹੁਤ ਟੇਸਟੀ ਬਣੇ ਅਤੇ ਉਹਨੂੰ ਵੀ ਬਹੁਤ ਪਸੰਦ ਆਏ ਉਹ